ਜਿੱਦਾਂ ਕਿ ਅਸੀਂ ਵੱਖ ਵੱਖ ਪਕਵਾਨਾਂ ਨੂੰ ਬਣਾਉਣ ਦੀ ਗੱਲ ਕਰੀਏ ਉਹਨਾਂ ਵਿੱਚੋਂ ਦੇਖਿਆ ਜਾਏ ਤਾਂ ਆਲੂ ਮਟਰਾਂ ਦੀ ਸਬਜ਼ੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਉਹਦੇ ਲਈ ਸਭ ਤੋਂ ਪਹਿਲਾਂ ਸਾਨੂੰ ਆਲੂਆਂ ਨੂੰ ਇੱਕ ਕੁੱਕਰ ਦੇ ਵਿੱਚ ਪਾ ਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਬਾਲਣ ਲਈ ਰੱਖ ਦੇਣਾ ਅਤੇ ਦੂਜੇ ਪਾਸੇ ਅਸੀਂ ਉਹਦਾ ਮਸਾਲਾ ਤਿਆਰ ਕਰ ਲਾਂਗੇ ਮਸਾਲੇ ਵਿੱਚ ਅਸੀਂ ਪਿਆਜ਼ ਲਸਣ ਅਦਰਕ ਮਿਰਚਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਘੋਟ ਲੈਣਾ ਅਤੇ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਇੱਕ ਕੜਾਹੀ ਦੇ ਵਿੱਚ ਤੇਲ ਗਰਮ ਕਰਨ ਲਈ ਰੱਖ ਦੇਣਾ ਜਦੋਂ ਉਹ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਉਹ ਦੇ ਵਿੱਚ ਅਸੀਂ ਥੋੜ੍ਹਾ ਜਿਹਾ ਜੀਰਾ ਪਾ ਦੇਣਾ ਫਿਰ ਉਸ ਤੋਂ ਬਾਅਦ ਵਿੱਚ ਆਹ ਸਾਰੀਆਂ ਅਦਰਕ ਮਿਰਚਾਂ ਅਤੇ ਪਿਆਜ਼ ਜਿਨਾਂ ਨੂੰ ਅਸੀਂ ਘੋਟਿਆ ਹੁੰਦਾ ਉਹਨੂੰ ਉਹਦੇ ਵਿੱਚ ਪਾ ਦੇਣਾ ਅਤੇ ਚੰਗੀ ਤਰ੍ਹਾਂ ਇਹ ਸਾਰੇ ਮਸਾਲੇ ਨੂੰ ਅਸੀਂ ਲਾਲ ਕਰ ਲੈਣਾ ਜਦੋਂ ਇਹ ਸਾਰਾ ਮਸਾਲਾ ਚੰਗੀ ਤਰ੍ਹਾਂ ਲਾਲ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਟਮਾਟਰ ਪਾ ਦੇਣੇ ਆ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਅਸੀਂ ਫਿਰ ਆਪਣੇ ਸਵਾਦ ਅਨੁਸਾਰ ਨਮਕ ਅਤੇ ਹੋਰ ਸਾਰੇ ਮਸਾਲੇ ਪਾ ਦਿੰਦੇ ਹਾਂ ਪੇਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਵਿੱਚ ਫਿਰ ਅਸੀਂ ਇਹਦੇ ਵਿੱਚ ਹਰੇ ਮਟਰ ਪਾ ਦੇਣੇ ਆ ਹਰੇ ਮਟਰਾਂ ਨੂੰ ਉਬਾਲਣ ਦੇ ਲਈ ਉਹਦੇ ਵਿੱਚ ਅਸੀਂ ਥੋੜ੍ਹਾ ਜਿਹਾ ਪਾਣੀ ਪਾ ਦੇਣਾ ਅਤੇ ਜਿਹੜੀ ਜਿਆ ਜਿਹੜੇ ਕਿ ਹਰੇ ਮਟਰ ਉਹ ਚੰਗੀ ਤਰ੍ਹਾਂ ਉਬਾਲੇ ਜਾਣ ਉਸ ਤੋਂ ਬਾਅਦ ਵਿੱਚ ਜਦੋਂ ਹਰੇ ਮਟਰ ਚੰਗੀ ਤਰ੍ਹਾਂ ਗਲ ਜਾਣਗੇ ਉਹਦੇ ਵਿੱਚ ਅਸੀਂ ਜਿਹੜੇ ਉਬਲੇ ਹੋਏ ਆਲੂ ਆ ਉਹਨਾਂ ਨੂੰ ਪਾ ਦੇਣਾ ਅਤੇ ਚੰਗੀ ਤਰ੍ਹਾਂ ਇਹਨਾਂ ਉਬਲੇ ਹੋਏ ਆਲੂਆਂ ਨੂੰ ਚੰਗੀ ਤਰ੍ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਉਸ ਤੋਂ ਬਾਅਦ ਵਿੱਚ ਉਹਦੇ ਵਿੱਚ ਅਸੀਂ ਜਿੰਨੀ ਕੁ ਅਸੀਂ ਸਬਜ਼ੀ ਚਾਹੀਦੀ ਹੁੰਦੀ ਆ ਉਹਦੇ ਅਨੁਸਾਰ ਅਸੀਂ ਉਹਦੇ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਅਸੀਂ ਸਬਜ਼ੀ ਨੂੰ ਰਿਝਾ ਦਵਾ ਦੇਣਾ ਕਿ ਤਾਂ ਕਿ ਜਿਹੜੀ ਸਾਡੀ ਸਬਜ਼ੀ ਆ ਉਹ ਵਧੀਆ ਤਰੀਕੇ ਦੇ ਨਾਲ ਬਣ ਜਾਵੇ ਅਤੇ ਜਦੋਂ ਅਸੀਂ ਸਬਜੀ ਨੂੰ ਵਧੀਆ ਤਰੀਕੇ ਦੇ ਨਾਲ ਚੰਗੀ ਤਰ੍ਹਾਂ ਮਸਾਲੇ ਭੁੰਨੇ ਹੋਣਗੇ ਸਭ ਕੁਝ ਕੀਤਾ ਹੋਏਗਾ ਅਤੇ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ ਅਤੇ ਇਹ ਸਬਜ਼ੀ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ